ਹਰ ਇੱਕ ਸਥਾਨ ਦੀ ਆਪਣੀ ਇੱਕ ਅਲੱਗ ਅਲੱਗ ਭਾਸ਼ਾ ਹੁੰਦੀ ਹੈ ਇਸੇ ਤਰ੍ਹਾਂ ਪੰਜਾਬ ਦੀ ਇੱਕ ਆਪਣੀ ਭਾਸ਼ਾ ਹੈ ਪੰਜਾਬੀ ਤਾਂ ਜਿਵੇਂ ਕਿ ਪੰਜਾਬ ਭਾਰਤ ਵਿੱਚ ਹੀ ਪੈਂਦਾ ਹੈ ਤਾਂ ਭਾਰਤ ਦੀ ਆਪਣੀ ਇੱਕ ਸਰਕਾਰੀ ਭਾਸ਼ਾ ਹੈ ਹਿੰਦੀ ਤਾਂ ਇਸਦਾ ਮਤਲਬ ਹੈ ਕਿ ਪੰਜਾਬ ਦੇ ਜਿਹੜੇ ਇਨਸਾਨ ਨੇ ਵਿਦਿਆਰਥੀ ਨੇ ਉਹਨਾਂ ਨੂੰ ਪੰਜਾਬੀ ਭਾਸ਼ਾ ਵੀ ਆਉਂਦੀ ਹੈ ਅਤੇ ਹਿੰਦੀ ਭਾਸ਼ਾ ਵੀ ਹੁੰਦੀ ਹੈ ਜਦ ਕਿ ਜਿਹੜੀ ਪੰਜਾਬੀ ਭਾਸ਼ਾ ਉਹ ਉਹਨਾਂ ਦੀ ਆਪਣੀ ਮਾਂ ਬੋਲੀ ਭਾਸ਼ਾ ਹੈ ਤਾਂ ਉਹਨਾਂ ਨੂੰ ਕਿਤੇ ਵੀ ਵਿਚਰਨ ਲਈ ਸਰਕਾਰੀ ਅਦਾਰਿਆਂ 'ਚ ਇੰਟਰਵਿਊ ਲਈ ਜਾਂ ਕਿਤੇ ਹੋਰ ਜਾਣ ਲਈ ਹਿੰਦੀ ਦੀ ਜ਼ਰੂਰਤ ਪੈਂਦੀ ਹੈ ਜਦ ਕਿ ਪੰਜਾਬੀ ਸਿਰਫ ਪੰਜਾਬ ਵਿੱਚ ਹੀ ਬੋਲੀ ਜਾਂਦੀ ਹੈ ਹਿੰਦੀ ਜਿਹੜੀ ਭਾਸ਼ਾ ਉਹ ਆਲ ਓਵਰ ਪੂਰੇ ਇੰਡੀਆ ਵਿੱਚ ਭਾਰਤ ਵਿੱਚ ਹੀ ਬੋਲੀ ਜਾਂਦੀ ਹੈ